ਮੈਂ ਆਪਣੀ ਸਹੇਲੀ ਦੇ ਵਿਆਹ ਲਈ ਖੁਦ ਇੱਕ ਡਿਜ਼ਾਇਨ ਕੀਤਾ ਸੂਟ ਪਾਇਆ ਸੀ ਪਰ ਉਸਨੂੰ ਬਣਾਉਣ ਦੇ ਲਈ ਬਹੁਤ ਮੁਸ਼ਕਲਾਂ ਆਈਆਂ ਕਿਉਂਕਿ ਉਸਦਾ ਡਿਜ਼ਾਇਨ ਬਹੁਤ ਅਲੱਗ ਸੀ ਉਸਦੇ ਉੱਤੋਂ ਬਹੁਤ ਕਢਾਈ ਕਰਨੀ ਪਈ ਸੀ ਇਸ ਲਈ ਬਹੁਤ ਸਮਾਂ ਲੱਗਿਆ ਚੁੰਨੀ ਪਰ ਗੋਟਾ ਜਿਹੜਾ ਲਾਉਣਾ ਸੀ ਬਹੁਤ ਮੁਸ਼ਕਲ ਨਾਲ਼ ਮਿਲਿਆ ਸੀ ਮੈਨੂੰ ਇਹ ਲਵਾਉਣ ਵਿੱਚ ਵੀਹ ਦਿਨ ਲੱਗ ਗਏ ਸੀ